ਜੇਕਰ ਅਸੀਂ ਅੱਜ ਕੱਲ੍ਹ ਤਕਨੀਕ ਦੇ ਮਾਮਲੇ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਏ ਆਈ ਆਰਟੀਫਿਸ਼ਅਲ ਇੰਟੈਲੀਜੈਂਸ ਦੀ ਬਹੁਤ ਜ਼ਿਆਦਾ ਮਹੱਤਤਾ ਵੱਧਦੀ ਜਾ ਰਹੀ ਹੈ ਅਤੇ ਸਾਡੇ ਨਾਲ ਕੀ ਹੋਇਆ ਸਾਡਾ ਪੇਪਰ ਸੀ ਸ਼ਸ਼ੋਲੌਜੀ ਦੇ ਵਿੱਚ ਤਾਂ ਉਸ ਵਿੱਚ ਇੱਕ ਕੁਅਸ਼ਚਨ ਸੀ ਕਿ ਇਸ ਟੋਪਿਕ ਨੂੰ ਕਿਹੜੇ ਰਾਈਟਰ ਨੇ ਲਿਖਿਆ ਹੈ ਅਤੇ ਅਸੀਂ ਉਸ ਵਿੱਚ ਜਿਹੜੇ ਨੋਟ ਸੀਗੇ ਉਹ ਚੈਟ ਜੀਪੀਟੀ ਲਈ ਨਾਮ ਦੇ ਆਰਟੀਫਿਸ਼ਅਲ ਇੰਟੈਲੀਜੈਂਸ ਤੋਂ ਮੇਰੇ ਦੋਸਤ ਨੇ ਬਣਾਏ ਹੋਏ ਸਨ ਅਤੇ ਅਸੀਂ ਨੋਟਬੁੱਕ ਦੇ ਵਿੱਚੋਂ ਉਹ ਨੋਟਸ ਪੜ੍ਹੇ ਉਸ ਵਿੱਚ ਲਿਖਿਆ ਸੀ ਲੋਅ ਔਫ ਓਲੀਗਾਰਕੀ ਮੈਨੂਅਲ ਕੈਸਲ ਦਾ ਲਿਖਿਆ ਹੋਇਆ ਹੈ ਅਤੇ ਅਸੀਂ ਸਾਰੇ ਉਸ ਵਿੱਚ ਜਦੋਂ ਕੁਅਸ਼ਚਨ ਆਇਆ ਉਹ ਪੇਪਰ ਵਿੱਚ ਤਾਂ ਅਸੀਂ ਸਾਰਿਆਂ ਨੇ ਅੱਖਾਂ ਬੰਦ ਕਰਕੇ ਰੋਬਰਟ ਮਿਸ਼ਲ 'ਤੇ ਕਲਿਕ ਕਰ ਦਿੱਤਾ ਪਰ ਇੱਕ ਸਾਡਾ ਦੋਸਤ ਜਿਸ ਨੇ ਕਿਤਾਬ ਵਿੱਚੋਂ ਪੜ੍ਹਿਆ ਹੋਇਆ ਸੀ ਅਤੇ ਉਸਨੇ ਕਿਹਾ ਕਿ ਨਹੀਂ ਇਸਦਾ ਅਨਸਰ ਰੋਬਰਟ ਹੈ ਪਰ ਅਸੀਂ ਉਸ 'ਤੇ ਯਕੀਨ ਨਾ ਕਰਕੇ ਆਪਣੇ ਪੜ੍ਹੇ ਹੋਏ 'ਤੇ ਯਕੀਨ ਕੀਤਾ ਅਤੇ ਪੇਪਰ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਡਾ ਅਨਸਰ ਗਲਤ ਸੀ ਤਾਂ ਇਸ ਤਰ੍ਹਾਂ ਟੈਕਨੋਲੋਜੀ ਸਾਨੂੰ ਗਲਤ ਵੀ ਰਾਹ ਦਿੰਦੀ ਹੈ